ਪੜ੍ਹਾਈ ਵਿੱਚ ਟੈਕਨੋਲੋਜੀ ਬਹੁਤ ਹੀ ਜ਼ਰੂਰੀ ਹੈ ਪਹਿਲਾਂ ਪਹਿਲੇ ਸਮੇਂ ਵਿੱਚ ਅਸੀਂ ਜਦੋਂ ਪੜ੍ਹਦੇ ਹੁੰਦੇ ਸੀ ਸਾਨੂੰ ਪਤਾ ਵੀ ਨਹੀਂ ਸੀ ਹੁੰਦਾ ਕੰਪਿਊਟਰ ਕੀ ਹੁੰਦਾ ਹੈ ਪਰ ਹੁਣ ਟੈਕਨੋਲੋਜੀ ਬਹੁਤ ਜ਼ਰੂਰੀ ਹੈ ਜਿਵੇਂ ਕਿ ਕੰਪਿਊਟਰ ਬਹੁਤ ਜ਼ਰੂਰੀ ਆ ਜਿਵੇਂ ਅਸੀਂ ਹੁਣ ਕੋਈ ਵੀ ਸਰਟੀਫਿਕੇਟ ਬਣਾਉਣਾ ਹੋਵੇ ਚਾਹੇ ਉਹ ਜਨਮ ਦਾ ਹੋਵੇ ਮੌਤ ਦਾ ਹੋਵੇ ਵਿਆਹ ਦਾ ਹੋਵੇ ਕੋਈ ਵੀ ਸਰਟੀਫਿਕੇਟ ਕਿਸੇ ਵੀ ਪ੍ਰਕਾਰ ਦਾ ਤਾਂ ਅਸੀਂ ਟੈਕਨੋਲੋਜੀ ਦੁਆਰਾ ਹੀ ਬਣਾਉਂਦੇ ਹਾਂ ਜਿਵੇਂ ਕੋਈ ਟੂਰਿਜ਼ਮ ਵਿੱਚ ਵੀ ਟੈਕਨੋਲੋਜੀ ਹੀ ਜ਼ਰੂਰਤ ਹੁੰਦੀ ਹੈ ਜਿਵੇਂ ਮੈਪ ਲੋਕੇਸ਼ਨ ਆਦਿ ਟੈਕਨੋਲੋਜੀ ਨੇ ਦੇਸ਼ ਵਿਦੇਸ਼ਾਂ ਨੂੰ ਆਪਸ ਵਿੱਚ ਇੱਕ ਪਰਿਵਾਰ ਬਣਾ ਦਿੱਤਾ ਹੈ ਕੋਈ ਵੀ ਅਸੀਂ ਕਿਤੋਂ ਇੱਕ ਦੇਸ਼ ਤੋਂ ਦੂਸਰੇ ਦੇਸ਼ ਜਾ ਰਹੇ ਹਾਂ ਤਾਂ ਉਹ ਵੀ ਅਸੀਂ ਟੈਕਨੋਲੋਜੀ ਦੀ ਹੀ ਮਦਦ ਨਾਲ ਜਾਂਦੇ ਹਾਂ ਕੋਈ ਵੀ ਕੰਮ ਆ ਅੱਜ ਦੇ ਸਮੇਂ ਵਿੱਚ ਟੈਕਨੋਲੋਜੀ ਦੀ ਮਦਦ ਨਾਲ ਹੀ ਹੋ ਰਿਹਾ ਹੈ ਕੋਈ ਵੀ ਆਨਲਾਈਨ ਸ਼ੋਪਿੰਗ ਕਰਦੇ ਹਾਂ ਜਾਂ ਅਸੀਂ ਘਰੇ ਬੈਠੇ ਕੋਈ ਜੋਬ ਕਰ ਰਹੇ ਹਾਂ ਤਾਂ ਉਹ ਟੈਕਨੋਲੋਜੀ ਦੀ ਹੀ ਮਦਦ ਨਾਲ ਹੋ ਰਿਹਾ ਵਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਅਸੀਂ ਕਮਾਈ ਦਾ ਸਾਧਨ ਆ ਜਾਂ ਸਾਡੇ ਕੋਲ ਘਰੇ ਬੈਠੇ ਤਾਂ ਉਹ ਟੈਕਨੋਲੋਜੀ ਦੀ ਹੀ ਮਦਦ ਨਾਲ ਆ ਇਸ ਕਰਕੇ ਹੁਣ ਦੇ ਸਮੇਂ ਵਿੱਚ ਟੈਕਨੋਲੋਜੀ ਬਹੁਤ ਹੀ ਜ਼ਰੂਰੀ ਹੈ ਬਹੁਤ ਜ਼ਿਆਦਾ ਜ਼ਰੂਰੀ ਹੈ ਧੰਨਵਾਦ